ਹੈਲੋ ਗੁਰਪ੍ਰੀਤ ਸੰਦੀਪ ਗੱਲ ਕਰ ਰਿਹਾ ਹੈਗਾ ਅੰਮ੍ਰਿਤਸਰ ਤੋਂ ਹਾਂਜੀ ਹਾਂਜੀ ਤੇ ਆ ਗਈ ਪਛਾਣ ਹਾਂ ਮੈਂ ਯਾਰ ਬਠਿੰਡੇ ਆਇਆ ਹੋਇਆ ਸੀਗਾ ਹਾਂ ਹੋਰ ਠੀਕ ਠਾਕ ਘਰ ਪਰਿਵਾਰ ਕਿੱਥੇ ਹੋ ਤੁਸੀਂ ਕਿੱਥੇ ਘਰ ਹੀ ਹੋ ਅੱਛਾ ਅੱਛਾ ਅਤੇ ਮੈਂ ਦੋ ਦਿਨ ਰਹਿਣਾ ਯਾਰ ਇੱਥੇ ਅਤੇ ਘੁੰਮਣ ਆਇਆ ਮੈਂ ਏ ਤੇ ਵਧੀਆ ਵਧੀਆ ਜਗ੍ਹਾ 'ਤੇ ਚਲਦੇ ਹਾਂ ਫਿਰ ਮਿਲਦੇ ਹਾਂ ਆਪਾਂ ਅਤੇ ਵੈਸੇ ਕਿਹੜੇ ਹਾਂ ਕਿ ਕਿਹੜੀ ਕਿਹੜੀ ਜਗ੍ਹਾ ਵਧੀਆ ਇੱਥੇ ਵੈਸੇ ਊਂ ਜ਼ਿਆਦਾ ਘੁੰਮਣ ਨੂੰ ਕਿਲ੍ਹਾ ਮੁਬਾਰਕ

ਅੱਛਾ ਅੱਛਾ ਅੱਛਾ ਅੱਛਾ ਅਤੇ ਵਧੀਆ ਜਗ੍ਹਾ ਕਿਹੜੀ ਹੈ ਫਿਰ ਆਪਾਂ ਉੱਥੇ ਹੀ ਚਲਦੇ ਹੈ ਨਾ ਓਕੇ ਠੀਕ ਆ ਠੀਕ ਹੈ

ਠੀਕ ਹੈ ਅੱਛਾ ਅੱਛਾ ਯਾਰ ਹਾਂ ਕਿਲ੍ਹਾ ਮੁਬਾਰਕ ਸੁਣਨ 'ਚ ਆਇਆ ਵੀ ਹਾਂ ਕਾਫੀ ਵਧੀਆ ਹੈ ਨਾ ਸੋਹਣਾ ਦੇਖਣ ਨੂੰ ਵੀ ਯਾਨੀ ਕਿ ਇਤਿਹਾਸ ਵੀ ਉਹਦਾ ਚੰਗਾ ਹੈਗਾ ਅਤੇ ਹੈ ਨਾ ਅੱਛਾ ਅੱਛਾ ਠੀਕ ਹੈ ਠੀਕ ਹੈ ਅਤੇ ਹੋਰ ਵੀ ਕੋਈ ਖਾਸ ਜਗ੍ਹਾ

ਠੀਕ ਹੈ

ਹਾਂ ਮੈਂ ਤਿੰਨ ਚਾਰ ਦਿਨਾਂ ਲਈ ਠੀਕ ਹੈ ਠੀਕ ਹੈ ਠੀਕ ਹੈ ਤਾਂ ਮੈਨੂੰ ਲੋਕੇਸ਼ਨ ਸੈਂਡ ਕਰੋਗੇ ਤੁਹਾਡੀ ਫਿਰ ਮੈਂ ਉਸ ਤਰ੍ਹਾਂ ਪਹੁੰਚ ਜਾਵਾਂ ਤੁਹਾਡੇ ਕੋਲ ਓਕੇ ਭਾਅ ਜੀ ਥੈਂਕਯੂ ਭਾਅ ਜੀ ਥੈਂਕਯੂ ਭਾਅ ਜੀ